ਹੈਲੋ ਹਾਂ ਅਮਨ ਠੀਕ ਆ ਮੈਂ ਮੈਂ ਵਧੀਆ ਵਧੀਆ ਅਤੇ ਹਾਂ ਉਹ ਅੱਜ ਮੈਂ ਵੈਸੇ ਫੋਨ ਕੀਤਾ ਸੀਗਾ ਪਟਿਆਲੇ ਦੇ ਵਧੀਆ ਵਧੀਆ ਸਕੂਲਾਂ ਬਾਰੇ ਪੁੱਛਣਾ ਸੀਗਾ ਕਿਵੇਂ ਦੇ ਨੇ ਕੋਈ ਆਈਡੀਆ ਹਾਂ ਹਾਂ ਡੀ ਪੀ ਐੱਸ 'ਚ ਅੱਛਾ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਖਰਚਾ ਖੁਰਚਾ ਜ਼ਿਆਦਾ ਹਾਂ ਆਹੋ ਐਂਹੀ ਸੁਣਿਆ ਸੀ ਮੈਨੂੰ ਵੀ ਅੱਜ ਵੈਸੇ ਵੀਰੇ ਨੇ ਕਿਹਾ ਸੀ ਵੀ ਆਪਣੇ ਫਰੈਂਡ ਸਰਕਲ 'ਚੋਂ ਪੁੱਛ ਲੈ ਵੀ ਉਹ ਵੀਰੇ ਦੇ ਮੁੰਡੇ ਨੂੰ ਅੱਗੇ ਪੜ੍ਹਾਉਣ ਲਾਉਣਾ ਸੀਗਾ ਵੀ ਕੋਣ ਕਿੱਥੇ ਕਿੱਥੇ ਪੜ੍ਹਦੇ ਨੇ ਮੈਂ ਕਿਹਾ ਚਲ ਮੈਂ ਪੁੱਛਦੀ ਹਾਂ ਵੀ ਅੰਗਦ ਨੂੰ ਕਿੱਥੇ ਲਾਇਆ ਵਾਈ ਪੀ ਐੱਸ ਸਕੂਲ ਕਿਵੇਂ ਹੈ ਸਾਨੂੰ ਹਾਂ ਹਾਂ ਸਾਨੂੰ ਵਾਈ ਪੀ ਐੱਸ ਵੀ ਨੇੜੇ ਪੈਂਦਾ ਉਹ ਕਿਵੇਂ ਆ ਹਾਂ ਵਾਈ ਪੀ ਐੱਸ ਹਾਂ ਚਲੋ ਹੁਣ ਜੇ ਪੜ੍ਹਾਉਣੇ ਆ ਤਾਂ ਫਿਰ ਪੈਸੇ ਤਾਂ ਹੈ ਨਾ ਲਾਉਣੇ ਹੀ ਪੈਣਗੇ ਅਤੇ ਵਾਈ ਹਮ ਹਮ ਬੁੱਢਾ ਦਲ ਦਾ ਫਿਰ ਉਹ ਥੋੜ੍ਹਾ ਇਹ 'ਚ ਨਹੀਂ ਕਰ ਦਿੰਦੇ ਜਿਵੇਂ ਅਕੈਡਮੀ ਹੋ ਗਿਆ ਬੁੱਢਾ ਦਲ ਉਹ ਰਸਟਿੱਕਸ਼ਨ ਜਿਹੀਆ ਥੋੜ੍ਹੀਆਂ ਜਿਹੀਆਂ ਹੋ ਜਾਂਦੀਆਂ ਉਹਨਾਂ ਦੀਆਂ ਮੈਨੂੰ ਲੱਗਦਾ ਕਿ ਨਹੀਂ ਅਕਾਲ ਅਕੈਡਮੀ 'ਚ ਹਾਂ ਹਾਂ ਕਿਉਂਕਿ ਐਂ ਨਾ ਸਾਨੂੰ ਆਏ ਆ ਵੀ ਬੱਚਾ ਸਿਰਫ ਰਸਟ੍ਰਿੱਕਸ਼ਨ ਜਿਹੀ 'ਚ ਨਾ ਹੋਵੇ ਵੀ ਆਪਣੇ ਜਿਵੇਂ ਉਹਦਾ ਮਨ ਕਰੇ ਉਵੇਂ ਸਕੂਲ ਜਾ ਸਕੇ ਤਾਂ ਕਰਕੇ ਵਾਈ ਪੀ ਐੱਸ ਜਾਂ ਫਿਰ ਇੱਕ ਸਕੋਲਰ ਹੈ ਸਕੂਲ ਹੈ ਨਾ ਇਹਦਾ ਦੇਖਦੇ ਹਾਂ ਇਹ ਸੋਚਦੇ ਪਏ ਸੀਗੇ ਨਾਲੇ ਭਾਬੀ ਉੱਧਰ ਨੂੰ ਜਾਂਦੇ ਨੇ ਪੜ੍ਹਾਉਣ ਆਪ ਵੀ ਅਤੇ ਨਾਲ ਹੀ ਛੱਡ ਦਿਆ ਕਰਨਗੇ ਵੈਸੇ ਭਾਬੀ ਜੀ ਡੀ ਏ ਵੀ 'ਚ ਸੀਗੇ ਹਾਂ ਇਹ ਵੀ ਹੋ ਸਕਦਾ ਹਾਂ ਵੈਸੇ ਡੈਮੋ ਤਾਂ ਉਹ ਦੇ ਹੀ ਦੇਣਗੇ ਹੈ ਨਾ ਆਪਾਂ ਵਿਜ਼ਟ ਤਾਂ ਕਰ ਹੀ ਆਵਾਂਗੇ ਠੀਕ ਹੈ ਠੀਕ ਹੈ ਭਈ ਓਕੇ ਚਲੋ ਓਕੇ